ਖੇਡਾਂ ਮਾਨਸਿਕ ਅਤੇ ਤੰਦਰੁਸਤ ਸਿਸਟਿਕ ਜੀਵਨ ਜਿਊਣ ਲਈ ਲੋਕਾਂ ਵਿੱਚ ਕਾਫੀ ਪ ਪ੍ਰਭਾਵਿਤ ਹੁੰਦੀ ਹੈ ਅਤੇ ਲੋਕ ਇਸ ਜੋ ਲੋਕ ਖੇ ਖਿਡਾਰੀ ਹੁੰਦੇ ਹਨ ਉਹ ਆਮ ਤੌਰ 'ਤੇ ਦੇਖ ਸਕਦੇ ਹਾਂ ਕਿ ਉਹ ਕਾਫੀ ਤਰ੍ਹਾਂ ਤੰਦਰੁਸਤ ਹੁੰਦੇ ਹਨ ਆ ਜਿਹਨਾਂ ਵਿੱਚ ਉਹ ਮਾਨਸਿਕ ਤੌਰ 'ਤੇ ਅਤੇ ਸਰੀਰ ਤੌਰ 'ਤੇ ਤੰਦਰੁਸਤ ਹੁੰਦੇ ਹਨ ਅਤੇ ਇਹ ਖੇਡਾਂ ਖੇਡਣ ਵਾਲਾ ਖਿਡਾਰੀ ਜਾਂ ਇਨਸਾਨ ਕਾਫੀ ਚੁਸਤ ਫੁਰਤੀਲਾ ਹੁੰਦਾ ਹੈ ਅਤੇ ਇਸ ਨਾਲ ਸਰੀਰ ਉਸਦਾ ਸਰੀਰ ਰਿਸ਼ਟ ਪੁਸ਼ਟ ਰਹਿੰਦਾ ਹੈ ਸੋ ਇਸ ਇਹ ਕਾਫੀ ਤਰੀਕੇ ਨਾਲ ਮਤਲਬ ਕਿ ਸਰੀਰ 'ਤੇ ਪ੍ਰਭਾਵ ਪਾਉਂਦੀਆਂ ਹਨ